ਅੱਜ ਕੱਲ੍ਹ ਬਹੁਤ ਸਾਰੇ ਕੋਰਸ ਹਨ ਜੋ ਟੈਕਨੋਲੋਜੀ ਅਤੇ ਕੰਪਿਊਟਰ ਬਾਰੇ ਪੜ੍ਹਾਉਂਦੇ ਹਨ ਅੱਜ ਕੱਲ੍ਹ ਤਾਂ ਸਕੂਲ ਦੇ ਵਿੱਚ ਹੀ ਕੰਪਿਊਟਰ ਸਿਖਾਉਣ ਲੱਗ ਜਾਂਦੇ ਹਨ ਛੋਟੇ ਬੱਚਿਆਂ ਤੋਂ ਨੂੰ ਹੀ ਪਰ ਅੱਜ ਕੱਲ੍ਹ ਕੁੱਝ ਜਿਹੜੇ ਮੁੱਖ ਕੋਰਸ ਹਨ ਜਿਵੇਂ ਕਿ ਬੀ ਟੈੱਕ ਕੰਪਿਊਟਰ ਇੰਨਜੀਨੀਅਰਿੰਗ ਬੀ ਐੱਸਸੀ ਐਨੀਮੇਸ਼ਨ ਬੀ ਸੀ ਏ ਜਿਸਦੀ ਫੁੱਲ ਫੌਮ ਹੈ ਬੈਚੁਲਰ ਇੰਨ ਕੰਪਿਊਟਰ ਐਪਲੀਕੇਸ਼ਨ